ਜੀ ਮੈਂ ਆਪਣੇ ਘਰ ਵਿੱਚ ਬਹੁਤ ਤਰ੍ਹਾਂ ਦੇ ਕੁਦਰਤੀ ਜੋ ਟਰੀ ਟਰੀਟਮੈਂਟ ਕਰਦੇ ਹਾਂ ਅਜਿਹੇ ਪੌਦੇ ਲਾ ਰੱਖੇ ਨੇ ਸਭ ਤੋਂ ਪਹਿਲਾ ਹੈਗਾ ਐਲੋ ਵੀਰਾ ਤੁਲਸੀ ਅਤੇ ਹੋਰ ਕਾਫੀ ਤਰ੍ਹਾਂ ਦੇ ਮੈਂ ਪੌਦੇ ਘਰ ਲਾ ਰੱਖੇ ਹਨ ਵੈਸੇ ਇਸ ਕੁਸ਼ਚਨ ਦਾ ਅਨਸਰ ਇਸ ਕੁਸ਼ਚਨ ਵਿੱਚ ਹੀ ਹੈ ਕਿ ਜਿਹੜੇ ਨੈਚੁਰਲ ਬੂਟੇ ਹੈਗੇ ਆ ਨੈਚੁਰਲ ਤਰੀਕੇ ਹੈਗੇ ਆ ਟਰੀਟਮੈਂਟ ਦੇ ਉਹ ਬਹੁਤ ਹੀ ਜ਼ਿਆਦਾ ਇਫੈਕਟਿਵ ਹੁੰਦੇ ਆ ਕਿਉਂਕਿ ਜਿਹੜੇ ਦੂਜੇ ਉਪਚਾਰ ਉਪਚਾਰਿਕ ਤਰੀਕੇ ਹੁੰਦੇ ਆ ਉਹਨਾਂ 'ਚ ਸਾਈਡ ਇਫੈਕਟ ਦੇ ਵੀ ਬਹੁਤ ਚਾਂਸਿਸ ਹੁੰਦੇ ਆ ਬਟ ਜਿਹੜੇ ਨੈਚੁਰਲ ਨੇ ਇਹਨਾਂ 'ਚ ਸਾ ਸਾਈਡ ਇਫੈਕਟ ਦਾ ਕੋਈ ਕੋਈ ਵੀ ਆਪਾਂ ਨੂੰ ਨਹੀਂ ਮਿਲਦਾ ਵੀ ਸਾਈਡ ਇਫੈਕਟ ਕਰਨਗੇ ਸੋ ਮੈਂ ਹਮੇਸ਼ਾ ਹੀ ਨੈਚੁਰਲ ਟਰੀਟਮੈਂਟ ਨੂੰ ਜ਼ਿਆਦਾ ਤਰਜੀਹ ਦਿੱਤੀ ਆ ਬਜਾਇ ਜੋ ਅੱਜ ਕੱਲ੍ਹ ਚੱਲ ਰਹੇ ਹੈਗੇ ਆਧੁਨਿਕ ਟ੍ਰੀਟਮੈਂਟ ਦੇ ਤਰੀਕੇ